ਹਾਂਜੀ ਫਰੀਡਮ ਫਾਈਟਰ ਆਪਣੇ ਪੰਜਾਬ ਵਿੱਚ ਸਾਰੇ ਕਾਫੀ ਤਕਰੀਬਨ ਫਰੀਡਮ ਫਾਈਟਰ ਦੇ ਫਰੀਡਮ ਫਾਈਟਰ ਹੀ ਰਹੇ ਨੇ ਸ਼ਹੀਦ ਭਗਤ ਸਿੰਘ ਦਾ ਨਾਮ ਲਓ ਤੁਸੀਂ ਰਾਜਗੁਰੂ ਸੁਖਦੇਵ ਜੀ ਦਾ ਨਾ ਲਓ ਬਾਲ ਗੰਗਾਧਰ ਤਿਲਕ ਦਾ ਨਾਮ ਲਓ ਮਤਲਬ ਇਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਉਂਦਾ ਬਹੁਤ ਵੱਡਾ ਉਸ ਟਾਈਮ ਯੋਗਦਾਨ ਪਾਇਆ ਸੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅਤੇ ਫਰੀਡਮ ਫਾਈਟਰ ਆਪਣੇ ਇੱਥੇ ਬਹੁਤ ਸਾਰੇ ਪਰਿਵਾਰ ਵੀ ਇਹੋ ਜਿਹੇ ਨੇ ਜਿਹਨਾਂ ਨੇ ਇਹਨਾਂ ਦੇ ਨਾਲ ਰਹਿ ਕੇ ਜੇਲਾਂ ਕੱਟੀਆਂ ਸੀ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਫਰੀਡਮ ਫਾਈਟਰ ਦਾ ਕਾਫੀ ਸਰਕਾਰ ਵੱਲੋਂ ਉਹਨਾਂ ਨੂੰ ਮਿਲਦਾ ਔਰ ਫਰੀਡਮ ਫਾਈਟਰ ਦੇ ਹਾਂਜੀ ਹਾਂਜੀ ਹਾਂਜੀ ਹਾਂਜੀ ਇਹਨਾਂ ਦਾ ਭਗਤ ਸਿੰਘ ਜੀ ਦੀ ਸਮਾਧ ਆਪਣੇ ਇੱਥੇ ਫਿਰੋਜ਼ਪੁਰ ਬਣੀ ਹੋਈ ਹੈ ਔਰ ਹਰ ਸਾਲ ਉਹਨਾਂ ਦੇ ਦਿਵਸ 'ਤੇ ਔਰ ਉਹਨਾਂ ਦੇ ਜਨਮ ਦਿਨ 'ਤੇ ਉੱਥੇ ਜਾਂਦੇ ਨੇ ਸਰਕਾਰ ਵੱਲੋਂ ਮੇਲੇ ਵੀ ਲੱਗਦੇ ਨੇ ਔਰ ਦੂਰ ਦੂਰ ਤੋਂ ਲੋਕ ਘੁੰਮਣ ਆਉਂਦੇ ਨੇ ਸਮਾਧ ਦੇਖਣ ਆਉਂਦੇ ਨੇ ਬਹੁਤ ਵਧੀਆ ਉਹਨਾਂ ਦਾ ਇੱਥੇ ਸਮਾਧੀ ਸਥਾਨ ਬਣਾਇਆ ਹੋਇਆ ਤਾਂ ਅਤੇ ਤੁਸੀਂ ਜਦੋਂ ਮਰਜ਼ੀ ਉੱਥੇ ਜਾ ਸਕਦੇ ਹੋ ਅਤੇ ਫਰੀਡਮ ਫਾਈਟਰ ਦੇ ਵਿੱਚ ਤਾਂ ਤੁਸੀਂ ਨਾਮ ਜਿੰਨੇ ਮਰਜ਼ੀ ਲਈ ਚਲੋ ਸਾਰੇ ਪੰਜਾਬ ਵਿੱਚ ਤਕਰੀਬਨ ਫਰੀਡਮ ਫਾਈਟਰ ਸੀ ਪਹਿਲਾਂ ਵੀ ਆਜ਼ਾਦੀ ਦੇ ਸਮੇਂ ਦੇ ਵਿੱਚ ਕਿਉਂਕਿ ਹਰ ਬੰਦਾ ਹੀ ਉੱਥੇ ਆਜ਼ਾਦੀ ਦੀ ਜੰਗ ਲੜਿਆ ਸੀ ਔਰ ਉਹਨਾਂ ਨੇ ਦੇਸ਼ ਜੋ ਆਜ਼ਾਦ ਕਰਾਨ ਦੇ ਵਿੱਚ ਜ਼ਿਆਦਾ ਯੋਗਦਾਨ ਦਿੱਤਾ ਸੀ ਅਤੇ ਹਾਂਜੀ ਠੀਕ ਹੈ ਜੀ ਓਕੇ ਜੀ ਕੋਈ ਗੱਲ ਨਹੀਂ ਕੋਈ ਲੋੜ ਪਵੇ ਤਾਂ ਹੋਰ ਦੁਬਾਰਾ ਤੁਸੀਂ ਦੱਸ ਦਿਓ ਜੇ ਅਤੇ ਮੈਂ ਤੁਹਾਨੂੰ ਹੋਰ ਮੇਰੇ ਕੋਲ ਬੁੱਕ ਵੀ ਹੈ ਫਰੀਡਮ ਫਾਈਟਰ ਦੀ ਤੁਹਾਨੂੰ ਦੇ ਦਿਆਂਗਾ ਠੀਕ ਹੈ ਜੀ ਓਕੇ